ਪੰਜਾਬ ਦਾ ਜਿਹੜਾ ਸੱਭਿਆਚਾਰਕ ਢਾਂਚਾ ਇਹਦੀ ਜੜ੍ਹ ਵਿੱਚ ਤਿੰਨ ਸਿਧਾਂਤ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ ਉਹ ਬੈਠੇ ਹੋਏ ਹਨ ਪਹਿਲਾਂ ਕਿਰਤ ਕਰਨਾ ਦੂਜਾ ਵੰਡ ਛਕਣਾ ਅਤੇ ਤੀਜਾ ਨਾਮ ਜਪਣਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਇਹ ਇੱਦਾਂ ਹਨ ਕਿ ਕਿਰਤ ਜਿਹੜੀ ਹੈ ਪੰਜਾਬ ਦੀ ਉਹ ਮੁੱਖ ਤੌਰ 'ਤੇ ਖੇਤੀਬਾੜੀ ਹੈ ਅਤੇ ਪੁਰਾ ਪੁਰਾਣਾ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਵੀ ਕੁਦਰਤ ਅਤੇ ਖੇਤੀਬਾੜੀ ਦੇ ਨਾਲ਼ ਜੁੜਿਆ ਹੋਇਆ ਹੈ ਅਤੇ ਆਪਸੀ ਆਪਸੀ ਪਿਆਰ ਅਤੇ ਆਪਸੀ ਸਾਂਝ ਨੂੰ

ਜ਼ਰੂਰੀ ਕਰਕੇ ਜਾਣਦਾ ਹੈ ਜਿਹੜੀ ਕਿ ਵੰਡ ਛਕੋ ਦੇ ਅੰਦਰੋਂ ਦਿਸਦੀ ਹੈ ਤੀਜਾ ਨਾਮ ਜਪੋ ਦਾ ਜਿਹੜਾ ਸਿਧਾਂਤ ਹੈ ਉਹ ਪੰਜਾਬੀ ਸੱਭਿਆਚਾਰ ਦਾ ਕਾਫ਼ੀ ਵੱਡਾ ਹਿੱਸਾ ਹੈ ਕਿ ਅਕਸਰ ਧਾਰਮਿਕ ਲੋਕਾਂ ਨੂੰ ਧਰਮ ਨੂੰ ਅਤੇ ਰੱਬੀ ਪਿਆਰ ਨੂੰ ਸੂਫ਼ੀ ਫ਼ਕੀਰੀ ਰੱਬੀ ਅਤੇ ਗੁਰਮੁਖੀ ਜੀਵਨ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ ਇਸ ਕਰਕੇ ਪਿੰਡਾਂ ਦੇ ਅੰਦਰ ਜਿਹੜੇ ਜ਼ਿਆਦਾਤਰ ਹੁਣ ਵੀ ਲੋਕ ਹਨ ਉਹ ਹੁਣ ਵੀ ਅਜੇ ਵੀ ਪਿੰਡਾਂ ਦੇ ਅੰਦਰ ਬਹੁਤੇ ਤੌਰ 'ਤੇ ਖੇਤੀ ਕਰਦੇ ਹਨ ਪੰਜਾਬ ਦੇ ਅੰਦਰ ਅਤੇ ਇਸ ਕਰਕੇ ਜਿਹੜਾ ਪਿੰਡਾਂ ਦਾ ਸਮੇਂ ਦਾ ਜਿਹੜਾ ਢਾਂਚਾ ਹੈ ਸਮੇਂ ਦੀ ਚਾਲ ਹੈ ਉਹ ਵੀ ਸ਼ਹਿਰਾਂ ਨਾਲ਼ੋਂ ਕਾਫ਼ੀ ਹੌਲੀ ਹੈ ਉਹ ਖੇਤੀਬਾੜੀ ਵਾਂਗ ਹੀ ਸਬਰ ਅਤੇ ਸੰਤੋਖ ਨਾਲ਼ ਹੌਲੀ ਹੌਲੀ ਜਿਵੇਂ ਫ਼ਸਲ ਪੱਕਦੀ ਹੈ ਇਵੇਂ ਹੀ ਹੌਲੀ ਹੌਲੀ ਬਹੁਤੇ ਕਾਰ ਵਿਹਾਰ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਉਹ ਇੱਦਾਂ ਹੀ ਹੌਲੀ ਹੌਲੀ ਹੁੰਦੇ ਹਨ ਵਿਆਹ ਹੋ ਗਏ ਵਿਆਹ ਲੰਬੇ ਲੰਬੇ ਸਮਿਆਂ ਤੱਕ ਵਿਆਹ ਚੱਲਦੇ ਹਨ ਤਿੰਨ ਤਿੰਨ ਚਾਰ ਚਾਰ ਦਿਨ ਸਾਰਾ ਪਿੰਡ ਸਾਂਝੇ ਤੌਰ 'ਤੇ ਵਿਆਹਾਂ ਦਾ ਸ਼ਮੂਲੀਅਤ ਭਰਦਾ ਜਾਗੋ ਨਿਕਲਦੀ ਹੈ ਘਰ ਘਰ ਜਾਇਆ ਜਾਂਦਾ ਸਾਂਝੀ ਰੋਟੀ ਪੱਕਦੀ ਹੈ ਅਤੇ ਆਮ ਤੌਰ 'ਤੇ ਸ਼ਾਮ ਨੂੰ ਵੀ ਜਿਹੜੀ ਦੁੱਧ ਦਹੀਂ ਲੱਸੀ ਦੀ ਸਾਂਝ ਹੈ ਉਹ ਇੱਕ ਘਰ 'ਚ ਜਿੱਦਾਂ ਜਿੱਧਰ ਜ਼ਿਆਦਾ ਡੰਗਰ ਪਸ਼ੂ ਨੇ ਲੋਕ ਇੱਕ ਦੂਜੇ ਦੇ ਘਰ 'ਚੋਂ ਲੱਸੀ ਮੱਖਣ ਇੱਕ ਦੂਜੇ ਨਾਲ਼ ਇਵੇਂ ਵੰਡਦੇ ਰਹਿੰਦੇ ਹਨ ਵਰਤਦੇ ਇੱਕ ਦੂਜੇ ਨਾਲ਼ ਵਰਤਦੇ ਰਹਿੰਦੇ ਹਾਂ ਅਤੇ ਚਾਰ ਪੰਜ ਜਾਣੇ ਸ਼ਾਮ ਨੂੰ ਇਕੱਠੇ ਹੋ ਕੇ ਇੱਕ ਜਾਣੇ ਦੇ ਘਰ ਕਈ ਵਾਰੀ ਰੋਟੀ ਖਾ ਲੈਂਦੇ ਹਾਂ ਅੱਜ ਇੱਧਰ ਖਾ ਲਈ ਅੱਜ ਉੱਧਰ ਪੱਕ ਲਈ ਤਾਂ ਇੱਦਾਂ ਕੋਈ ਬਹੁਤ ਜ਼ਿਆਦਾ ਵੱਖ ਵੱਖ ਜੀਵਨ ਸ਼ੈਲੀ ਨਹੀਂ ਹੈ ਜੁੜੀ ਹੋਈ ਜੀਵਨ ਸ਼ੈਲੀ ਹੈ ਪਿੰਡਾਂ ਦੇ ਅੰਦਰ ਸਾਰਿਆਂ ਦੀ ਤਾਂ ਜਿਹੜਾ ਇਹ ਸਾਂਝ ਦਾ ਕੁਦਰਤ ਨਾਲ਼ ਜੁੜਿਆ ਹੋਇਆ ਸੱਭਿਆਚਾਰ ਹੈ ਇਹ ਪਿੰਡਾਂ ਦੇ ਅੰਦਰ ਗੁਰਦੁਆਰਿਆਂ ਤੋਂ ਵੀ ਦਿਸਦਾ ਹੈ ਸ਼ਾਮ ਨੂੰ ਜਦੋਂ ਪਾਠੀ ਘੰਟੀ ਮਾਰਦਾ ਹੈ ਤਾਂ ਸਾਰੇ ਪਿੰਡ ਦੇ ਲੋਕ ਸ਼ਾਮ ਵੇਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬਾਂ ਦੇ ਅੰਦਰ ਜੁੜਦੇ ਹਨ ਪਿੰਡ ਦੇ ਹਿੰਦੂ ਲੋਕ ਧਰਮਸ਼ਾਲਾਵਾਂ ਅਤੇ ਮੰਦਰਾਂ 'ਚ ਜੁੜਦੇ ਹਨ ਅਤੇ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਦੀ ਧਰਮਸ਼ਾਲਾ ਦੇ ਅੰਦਰ ਮੁਸਲਮਾਨ ਹਿੰਦੂ ਦੇ ਪਿੰ ਪਿੰਡ ਦੇ ਹੋਰ ਸਾਰੇ ਧਰਮਾਂ ਦੇ ਲੋਕ ਵੀ ਇਕੱਠੇ ਹੋ ਕੇ ਜਿਹੜੇ ਆਪਣੇ ਧਰਮ ਦੇ ਕੋਈ

ਮਨਾਉਣ ਵਾਲੇ ਪੁਰਬ ਦੀ ਜਾਂ ਦਿਨ ਹੁੰਦੇ ਹਨ ਉਹ ਇਕੱਠੀ ਸਾਂਝੀ ਧਰਮਸ਼ਾਲਾ ਦੇ ਵਿੱਚ ਵੀ ਮਨਾ ਲਏ ਜਾਂਦੇ ਹਨ ਤਾਂ ਇਸ ਕਰਕੇ ਜਿਹੜੀ ਧਰਮ ਦੀ ਅਤੇ ਕਿਰਤ ਦੀ ਸਾਂਝ ਹੈ ਇਹ ਜੁੜੀ ਹੋਈ ਹੈ ਪਿੰਡਾਂ ਦੇ ਸੱਭਿਆਚਾਰ ਦੇ ਅੰਦਰ ਪਰ ਜਿਹੜੇ ਸ਼ਹਿਰਾਂ ਦੇ ਅੰਦਰ ਜਿਹੜਾ ਢਾਂਚਾ ਏ ਇਹ ਥੋੜ੍ਹਾ ਬਦਲ ਗਿਆ ਕਿਉਂਕਿ ਇੱਕ ਤਾਂ ਸ਼ਹਿਰਾਂ ਦੇ ਅੰਦਰ ਜਿਹੜਾ ਸਮਾਂ ਉਹ ਬਹੁਤ ਸੀਮਿਤ ਹੁੰਦਾ ਜਿਸ ਕਰਕੇ ਸ਼ਹਿਰੀ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਉਹ ਵੀ ਇੱਕ ਦੂਜੇ ਨਾਲ਼ ਜੁੜੀ ਹੋਈ ਘੱਟ ਹੁੰਦੀ ਹੈ ਉਹ ਆਪਣੀ ਆਪਣੀ ਜਿਹੜਾ ਆਪਣੇ ਆਪ ਦੇ ਵਿੱਚ ਰਹਿਣਾ ਪਰਿਵਾਰ ਨੇ ਜਾਂ ਤਾਂ ਆਪਣੇ ਆਪ 'ਚ ਰਹਿਣਾ ਪਰਿਵਾਰ ਦੇ ਅੰਦਰ ਵੱਖ ਵੱਖ ਪਰਿਵਾਰਿਕ ਮੈਂਬਰਾਂ ਨੇ ਆਪਣੇ ਆਪ ਦੇ ਅੰਦਰ ਅੰਦਰ ਅੰਦਰ ਰਹਿਣਾ ਇਸ ਕਰਕੇ ਜਿਹੜਾ ਜਿਹੜਾ ਇੱਕ ਦੂਜੇ ਨਾਲ਼ ਜੁੜਨ ਦਾ ਕਿਰਤ ਨਾਲ਼ ਜੁੜਨ ਦਾ ਅਤੇ ਵੰਡ ਛਕਣ ਦਾ ਜਿਹੜਾ ਸਿਧਾਂਤ ਹੈ ਉਹ ਸ਼ਹਿਰਾਂ ਦੇ ਅੰਦਰ ਦਿਸਦਾ ਤਾਂ ਹੈ ਪਰ ਉਨਾਂ ਬੇਮਿਸਾਲੀ ਨਾਲ਼ ਨਹੀਂ ਦਿਸਦਾ ਜਿੰਨਾਂ ਪਿੰਡਾਂ ਨਾਲ਼ ਦਿਸਦਾ ਪਰ ਦੂਜੀ ਗੱਲ ਇਹ ਹੈ ਕਿ ਸ਼ਹਿਰਾਂ ਦੇ ਅੰਦਰ ਹੋਰ ਜਿਹੜੇ ਗੁਰਦੁਆਰਾ ਸਾਹਿਬ ਜਾਂ ਜਾਂ ਮੰਦਰ ਮਸਜਿਦਾਂ ਹੁੰਦੀਆਂ ਹਨ ਉਹਨਾਂ ਦੇ ਅੰਦਰ ਲੋਕ ਜ਼ਿਆਦਾਤਰ ਆ ਕੇ ਜੁੜਦੇ ਹਨ ਸਕੂਲਾਂ ਦੇ ਜਿਹੜੇ ਹੋ ਗਏ ਔਫਿਸ ਜਿਹੜੀਆਂ ਇਹ ਸਾਰੀਆਂ ਬਿਲਡਿੰਗਾਂ ਅਤੇ ਕਾਰ ਵਿਹਾਰ ਵਾਲੀਆਂ ਸਰਕਾਰੀ ਬਿਲਡਿੰਗਾਂ ਹੁੰਦੀਆਂ ਹਨ ਇਹ ਵੀ ਸਾਂਝ ਦਾ ਖੇਤਰ ਬਣ ਜਾਂਦੀਆਂ ਅਤੇ ਸ਼ਹਿਰੀਕਰਨ ਹੋਣ ਕਾਰਨ ਪੰਜਾਬ ਦਾ ਅੱਜ ਕੱਲ੍ਹ ਤਾਂ ਸ਼ਹਿਰਾਂ ਅਤੇ ਪਿੰਡਾਂ ਦਾ ਅੰਤਰ ਵੀ ਘੱਟਦਾ ਜਾ ਰਿਹਾ ਦੋਵਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਪੇਂਡੂਆਂ ਵਾਲੇ ਗੁਣ ਅਤੇ ਪਿੰਡਾਂ ਦੇ ਅੰਦਰ ਸ਼ਹਿਰਾਂ ਵਾਲੇ ਜਿਹੜੇ ਗੁਣ ਹਨ ਉਹ ਅਦਲਾ ਬਦਲੀ ਅਤੇ ਰਲੇ ਮਿਲੇ ਜਾ ਰਹੇ ਹਨ ਜਿਸ ਕਰਕੇ ਕਈ ਸ਼ਹਿਰ ਸ਼ਹਿਰ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਜਿੱਦਾਂ ਆਪਾਂ ਸ਼ਹਿਰਾਂ ਨੂੰ ਸਮਝਦੇ ਆ ਕਿ ਕਿ ਕਲਮ ਕੱਲਾ ਵਾਲੀ ਜ਼ਿੰਦਗੀ ਹੋ ਗਈ ਉੱਦਾਂ ਵੀ ਨਹੀਂ ਹੈ ਬਹੁਤੇ ਸ਼ਹਿਰ ਕਈ ਪਿੰਡਾਂ ਵਰਗੇ ਵੀ ਹਨ ਜਿੱਦਾਂ ਫਤਿਹਗੜ੍ਹ ਸਾਹਿਬ ਅਤੇ ਕਈ ਪਿੰਡ ਵੀ ਜ਼ਿਆਦਾਤਰ ਸ਼ਹਿਰਾਂ ਨਾਲ਼ ਜੁੜੇ ਹੋਣ ਕਰਕੇ ਜਿਹੜੇ ਚੰਡੀਗੜ੍ਹ ਦੇ ਨੇੜੇ ਦੇ ਕਈ ਪਿੰਡ ਉਹ ਉੱਦਾਂ ਦੇ ਸ਼ਹਿਰਾਂ ਵਰਗੇ ਵੀ ਹੋ ਗਏ ਹਨ ਤਾਂ ਇਹ ਕਿਹੜਾ ਸ਼ਹਿਰ ਕਿਹੜਾ ਪਿੰਡ ਹੈ ਇਹਦੇ ਉੱਤੇ ਵੀ ਨਿਰਭਰ ਕਰਦਾ ਹੈ